ਮੇਰਾ ਸਭ ਤੋਂ ਪਹਿਲਾ ਮਲਕੀਅਤ ਵਾਲਾ ਸਮਾਟਫੋਨ ਐਗਜੋਮੀ ਰੈਡਮੀ ਫੋਰ ਸੀ ਇਸਦੀ ਜਿਹੜੀ ਸ ਮੇ ਸਕਰੀਨ ਸੀ ਉਹ ਪੰਜ ਇੰਚ ਸੀ ਅਤੇ ਇਹ ਇਹਦਾ ਕੈਮਰਾ ਤੇਰ੍ਹਾਂ ਮੈਗਾਪਿਕਸਲ ਅਤੇ ਇਸਦੀ ਬੈਟਰੀ ਟਾਈਪ ਸੀ ਜੋ ਇੱਕਤਾਲੀ ਸੌ ਇੱਕਤਾਲੀ ਸੌ ਐੱਮ ਏ ਐੱਚ ਸੀ ਇਹਦੇ ਵਿੱਚ ਜੋ ਸੀਗਾ ਆਪਣਾ ਪ੍ਰੋਸੈਸਰ ਉਸ ਟਾਈਮ ਜੋ ਮਬੈਲ ਫੋਨ ਆਉਂਦੇ ਸੀ ਉਹ ਉਨ੍ਹਾਂ ਨਾਲੋਂ ਬਹੁਤ ਵਧੀਆ ਸੀ ਇਸ ਕਰਕੇ ਮਬੈਲ ਫੋਨ ਲਿਆ ਸੀ ਬੱਟ ਜਿਵੇਂ ਜਿਵੇਂ ਆਪਾਂ ਮਬੈਲ ਫੋਨ ਨੂੰ ਯੂਜ ਕਰਦੇ ਰਹੇ ਨਵੀਆਂ ਨਵੀਆਂ ਟੈਕਨੋਲਜੀਆਂ ਆਉਂਦੀਆਂ ਪੁਰਾਣੇ ਮਬੈਲ ਫੋਨ ਸੀ ਜਿਹੜਾ ਉਹ ਬੋਰਿੰਗ ਫੀਲ ਹੋਣ ਲੱਗ ਗਿਆ ਸੀਗਾ ਜੋ ਕਿ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਕੈਮਰਿਆਂ ਵਿੱਚ ਪ੍ਰਸੈਸਰਾਂ ਦੀ ਪ੍ਰਸੈਸਰ ਵਧੀਆ ਆਉਣ ਲੱਗ ਗਏ ਕੈਮਰਾ ਕੁਆਲਟੀ ਵਧੀਆ ਆਉਣ ਲੱਗ ਗਈ ਇਸ ਤੋਂ ਬਾਅਦ ਮੈਨੇ ਫ ਸਮਾਟਫੋਨ ਲਿਆ ਰੈਡਮੀ ਨੋਟ ਏਟ ਪ੍ਰੋ ਉਸਦਾ ਕੈਮਰਾ ਕੁਆਲਟੀ ਸੀਗੀ ਜਿਹੜੀ ਉਹ ਅਠਤਾਲੀ ਮੈਗਾਪਿਕਸਲ ਸੀ ਇਸ ਦਾ ਪ੍ਰਸੈਸਰ ਸੀ ਜੋ ਸਨੈਪਡਰੈਗਨ ਪ੍ਰਸੈਸਰ ਸੀਗਾ ਇਸਦੀ ਜੋ ਮੈਮਰੀ ਸੀਗੀ ਉਹ ਅੱਠ ਜੀ ਬੀ ਅਤੇ ਇੱਕ ਸੌ ਅਠਾਈ ਜੀ ਬੀ ਸੀ ਅਤੇ ਜੋ ਕਿ ਚਲਾਉਣ ਵਿੱਚ ਬਹੁਤ ਵਧੀਆ ਸੀ ਪਰ ਜਿਵੇਂ ਜਿਵੇਂ ਸਮਾਂ ਬਦਲਦਾ ਜਾਂਦਾ ਉਵੇਂ ਉਵੇਂ ਮਬੈਲ ਫੋਨ ਦੀ ਜੋ ਵਰਤੋਂ ਦੇ ਨਾਲ ਨਾਲ ਇਨ੍ਹਾਂ ਦੇ ਫੀਚਰ ਵੀ ਚੇਂਜ ਪੁਰਾਣੀ ਚੀਜ਼ ਆਪਾਂ ਨੂੰ ਬੇਕਾਰ ਲੱਗਣ ਲੱਗ ਜਾਂਦੀ ਹੈ ਇਸਦੇ ਨਵੇਂ ਨਵੇਂ ਟੈਕਨੀਕ ਆ ਰਹੀਆਂ ਨੇ ਇਹਦੇ ਨਾਲ ਜੋ ਮਬੈਲ ਫੋਨ ਹੈ ਉਹ ਪੁਰਾਣੇ ਨਾਲ ਆਪਾਂ ਬੋਰਿੰਗ ਫੀਲ ਕਰਨ ਲੱਗ ਜਾਂਦੇ ਇਸ ਕਰਕੇ ਆਪਾਂ ਨਵੇਂ ਮਬੈਲ ਫੋਨ ਖਰੀਦਦੇ ਜਾਂਦੇ ਹੈ ਧੰਨਵਾਦ